ਹੈਲੋ ਹਾਂਜੀ ਮੈਂ ਪੇਂਟਰ ਹਾਂ ਹਾਂਜੀ ਤੁਸੀਂ ਕਿੱਦਾਂ ਦਾ ਪੇਂਟ ਕਰਵਾਉਣਾ ਅੱਜ ਕੱਲ੍ਹ ਜਿਵੇਂ ਵਾਲਪੇਪਰ ਚੱਲੇ ਤੁਸੀਂ ਪ੍ਰਿੰਟਡ ਵਾਲਪੇਪਰ ਲਗਵਾਉਣਾ ਜਾਂ ਫਿਰ ਬਿਰਲਾ ਪੁੱਟੀ ਕਰਵਾਉਣੀ ਹੈ ਜਾਂ ਫਿਰ ਅੱਜ ਕੱਲ੍ਹ ਪੀ ਓ ਪੀ ਵੀ ਕਰਵਾਉਂਦੇ ਆ ਲੋਕ ਉਹ ਬਹੁਤ ਵਧੀਆ ਰਹਿੰਦੀ ਹੈ ਆਪਾਂ ਛੱਤ 'ਤੇ ਪੀ ਓ ਪੀ ਕਰ ਸਕਦੇ ਹਾਂ ਉਹਦੇ ਨਾਲ ਡੈਕੋਰੇਟਿਵ ਹੋ ਜਾਂਦਾ ਅਤੇ ਪੱਖੇ ਅਤੇ ਏ ਸੀ ਲੱਗੇ ਬਹੁਤ ਸੋਹਣੇ ਲੱਗਦੇ ਹੈ ਤੁਸੀਂ ਕਿਹੜਾ ਕਰਵਾਉਂਗੇ ਤੁਹਾਨੂੰ ਵਾਲਪੇਪਰ ਸੈੱਟ ਰਹੂਗਾ ਤੁਹਾਨੂੰ ਵਾਲਪੇਪਰ ਸੈੱਟ ਰਹੂਗਾ ਅਤੇ ਹਾਂਜੀ ਵਾਲਪੇਪਰ ਠੀਕ ਰਹੇਗਾ ਉਹ ਨਾ ਤਾਂ ਜਲਦੀ ਫੱਟਦਾ ਹੈ ਅਤੇ ਨਾ ਹੀ ਪੇਂਟ ਵਾਂਗੂ ਉਤਰਦਾ ਹੈ ਤਾਂ ਤੁਹਾਨੂੰ ਵਾਲਪੇਪਰ ਸੈੱਟ ਹਾਂਜੀ ਉਹ ਵੀ ਆਪਾਂ ਕਰ ਸਕਦੇ ਹਾਂ ਅਤੇ ਪ੍ਰਾਈਜ ਉਹਨਾਂ ਦਾ ਬਹੁਤ ਥੋੜ੍ਹਾ ਹੈ ਵਾਲਪੇਪਰ ਦਾ ਪ੍ਰਾਈਜ ਬਹੁਤ ਘੱਟ ਹੈ ਤੁਹਾਨੂੰ ਠੀਕ ਹੈ ਤੁਹਾਨੂੰ ਤੁਹਾਨੂੰ ਉਹਨਾਂ ਦਾ ਪ੍ਰਾਈਜ਼ ਆਪਾਂ ਕਰ ਸਕ ਆਪਾਂ ਉਹ ਬਾਅਦ ਚੋਂ ਡਿਸਾਈਡ ਕਰ ਲਵਾਂਗੇ ਪਰ ਵੈਸੇ ਨੀਅਰ ਅਬਾਉਟ ਦਸ ਹਜ਼ਾਰ ਲੱਗ ਜਾਂਦਾ ਇੱਕ ਕਮਰੇ ਦਾ ਹਾਂਜੀ ਤਾਂ ਤੁਹਾਨੂੰ ਉਹ ਸੈੱਟ ਰਹੇਗਾ ਓਕੇ ਤਾਂ ਫਿਰ ਤੁਸੀਂ ਸਾਨੂੰ ਫੋਨ ਕਰਕੇ ਦੱਸ ਦਿਓ ਕਿੰਨਾ ਤੁਹਾਨੂੰ ਸਾਨੂੰ ਫੋਨ ਕਰਕੇ ਦੱਸ ਦਿਓ ਤੁਹਾਨੂੰ ਕਦੋਂ ਤੱਕ ਸੈੱਟ ਰਹੇਗਾ ਅਤੇ ਸਾਨੂੰ ਤੁਸੀਂ ਫੋਨ ਕਰਕੇ ਦੱਸ ਦਿਓ ਜੀ ਅਸੀਂ ਤੁਹਾਨੂੰ ਫਿਰ ਕੌਲ ਕਰ ਬਾਬ ਆ ਕੇ ਤੁਹਾਨੂੰ ਦੱਸ ਪੇਂਟ ਤੋਂ ਦੱਸ ਦਵਾਂਗੇ ਵੀ ਕਿਹੜੇ ਵਾਲਪੇਪਰ ਤੁਸੀਂ ਲਗਵਾਉਣੇ ਹੈ ਅਤੇ ਉਹ ਪ੍ਰਿੰਟ ਕਰਵਾ ਲਵਾਂਗੇ ਵੱਡੇ ਸਾਈਜ 'ਚ ਓਕੇ ਠੀਕ ਹੈ